ਮੈਂ ਸ਼ੀਤਲ ਕੁਮਾਰੀ ਵਾਸੀ ਮਿਰਜ਼ਾਪੁਰ ਪਠਾਨਕੋਟ ਜ਼ਿਲ੍ਹੇ ਦੀ ਰਹਿਣ ਵਾਲੀ ਹਾਂ ਮੈਂ ਦੱਸਣਾ ਚਾਹੁੰਦੀ ਹਾਂ ਕਿ ਸਾਡੇ ਖੇਤਰ ਵਿੱਚ ਸਾਡੇ ਇਲਾਕੇ ਵਿੱਚ ਜੋ ਕਿ ਮੁੱਖ ਰੁਜ਼ਗਾਰ ਦੇ ਸਾਧਨ ਬਹੁਤ ਹਨ ਕਿਉਂਕਿ ਜਿਹੜਾ ਇਨਸਾਨ ਮਿਹਨਤ ਕਰਦਾ ਹੈ ਉਸ ਲਈ ਕੰਮ ਦੀ ਘਾਟ ਨਹੀਂ ਹੈ ਸਾਡੇ ਇਲਾਕੇ ਵਿਚ ਕਈ ਤਰ੍ਹਾਂ ਦੇ ਕੰਮ ਹਨ ਜਿਸ ਤਰ੍ਹਾਂ ਖੇਤੀਬਾੜੀ ਦੇ ਕੰਮ ਆਮ ਮਿਲ ਜਾਂਦੇ ਹਾਂ ਲੋਕ ਜਿਮੀਦਾਰ ਹਨ ਉਹ ਖੇਤਾਂ ਵਿਚ ਫਸਲਾਂ ਦਾ ਕੰਮ ਫਸਲਾਂ ਲਗਾਉਣੀਆ ਕਟਾਉਣੀਆਂ ਜਾਂ ਹੋਰ ਇਸ ਤਰ੍ਹਾਂ ਦੀ ਦੇਖ ਰੇਖ ਕਰਨ ਦੇ ਕਈ ਤਰ੍ਹਾਂ ਦੇ ਕੰਮ ਆਮ ਮਿਲ ਜਾਂਦੇ ਹਨ ਜੇਕਰ ਮੈਂ ਗੱਲ ਕਰਾਂ ਤਾਂ ਇਸ ਤੋਂ ਇਲਾਵਾ ਸਾਡੇ ਇਲਾਕੇ ਵਿੱਚ ਮਜ਼ਦੂਰੀ ਦਾ ਕੰਮ ਬਹੁਤ ਜ਼ਿਆਦਾ ਹੈ ਜਿਸ ਤਰ੍ਹਾਂ ਮਿਸਤਰੀ ਦੇ ਨਾਲ ਮਜ਼ਦੂਰੀ ਕਰਨਾ ਆਦਿ ਸਭ ਸਾਡੇ ਸੰਯੋਗ ਦੇ ਨਾਲ ਹੀ ਹੋਇਆ ਹੈ ਇਹ ਸਾਡੇ ਸਾਡੀ ਮਿਹਨਤ ਦੇ ਨਾਲ ਨਾਲ ਚੱਲਦਾ ਹੈ ਜੇਕਰ ਅਸੀਂ ਮਿਹਨਤ ਕਰਾਂਗੇ ਤਾਂ ਸਾਨੂੰ ਸਦਾ ਰੁਜ਼ਗਾਰ ਮਿਲੇਗਾ ਅਸੀਂ ਰੁਜ਼ਗਾਰ ਦੀ ਭਾਲ ਇਸ ਇੱਧਰ ਉੱਧਰ ਫਿਰਦੇ ਰਹਿੰਦੇ ਹਾਂ ਅਤੇ ਸਾਨੂੰ ਰੁਜ਼ਗਾਰ ਆਮ ਮਿਲ ਜਾਂਦਾ ਹੈ ਕਿਉਂਕਿ ਕਈ ਲੋਕ ਸਾਡੇ ਨੇੜੇ ਸ਼ਹਿਰ ਸੁਜਾਨਪੁਰ ਪਠਾਨਕੋਟ ਵਿਖੇ ਜ਼ਿਆਦਾ ਕਿਉਂਕਿ ਉੱਥੇ ਪੂਰੇ ਸ਼ਹਿਰ ਦੇ ਲੋਕਾਂ ਨੂੰ ਜਿਹਨਾਂ ਨੇ ਕੋਈ ਕੋਈ ਨਾ ਕੋਈ ਘਰ ਕੰਮ ਲਗਾਇਆ ਹੁੰਦਾ ਹੈ ਉਹਨਾਂ ਨੂੰ ਮਜ਼ਦੂਰੀ ਕਰਨ ਵਾਸਤੇ ਮਜ਼ਦੂਰ ਮਿਸਤਰੀ ਦਾ ਕੰਮ ਕਰਨ ਵਾਸਤੇ ਮਿਸਤਰੀ ਆਦਿ ਜਾਂ ਕਾਰਪੈਂਟਰ ਦੀ ਲੋੜ ਪੈਂਦੀ ਹੈ ਸਾਨੂੰ ਉੱਥੇ ਜਾ ਕੇ ਆਮ ਰੁਜ਼ਗਾਰ ਮਿਲ ਜਾਂਦਾ ਹੈ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਸਾਡੇ ਖੇਤਰ ਜਾਂ ਸਾਡੇ ਇਲਾਕੇ ਵਿੱਚ ਰੁਜ਼ਗਾਰ ਦੇ ਅਨੇਕ ਸਾਧਨ ਹਨ ਪਰ ਸਾਨੂੰ ਮਿਹਨਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਧੰਨਵਾਦ ਜੀ